ਹੈਲੋ ਹਾਂਜੀ ਦੀਦੀ ਕਿੱਦਾਂ ਕੀ ਹਾਲ ਚਾਲ ਹੈ ਹਾਂਜੀ ਬਸ ਵਧੀਆ ਹੋਰ ਪਰਿਵਾਰ ਦਾ ਸੁਣਾਓ ਬੱਚੇ ਕੀ ਕਰਦੇ ਨੇ ਬੱਚੇ ਕਿਹੜੇ ਸਕੂਲ 'ਚ ਪੜ੍ਹ ਰਹੇ ਨੇ ਮੈਂ ਨਾ ਹਾਂਜੀ ਮੈਂ ਆਪਣੇ ਬੱਚੇ ਨਾ ਸਕੂਲ ਬਦਲੀ ਕਰਨਾ ਚਾਹੁੰਦੀ ਹਾਂ ਤੁਹਾਨੂੰ ਪਤਾ ਜਿੱਦਾਂ ਇਹ ਹਰਕਿਸ਼ਨ ਪੜ੍ਹ ਰਹੇ ਨੇ ਉੱਥੇ ਆਈ ਸੀ ਐੱਸ ਈ ਆ ਸਟੱਡੀ ਤਾਂ ਬੜੀ ਮੁਸ਼ਕਿਲ ਆ ਰਹੀ ਹੈ ਤੁਹਾਨੂੰ ਪਤਾ ਬੱਚਿਆਂ ਨੂੰ ਆਈ ਸੀ ਐੱਸ ਈ ਸਿਲੇਬਸ ਵਿੱਚ ਕਿੰਨਾਂ ਕਿੰਨਾਂ ਮੁਸ਼ਕਿਲ ਹੋ ਜਾਂਦੀ ਆ ਅੱਗੋਂ ਵੀ ਫਿਰ ਮੁਸ਼ਕਿਲ ਆ ਜਾਂਦੀ ਹੈ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਚਲੋ ਇਹਨਾਂ ਦਾ ਸਕੂਲ ਬਦਲੀ ਕਰ ਦਿੱਤਾ ਜਾਵੇ ਕਿਹੜੇ ਕਿਹੜੇ ਸਕੂਲ ਬੈੱਸਟ ਵਧੀਆ ਨੇ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਅਤੇ ਤੁਹਾਨੂੰ ਕੀ ਲੱਗਦਾ ਕਿ ਮੈਂ ਕਿਸ ਤਰ੍ਹਾਂ ਮਤਲਬ ਕਿਹੜੇ ਸਕੂਲ ਹੋਰ ਕਿਹੜੇ ਕਿਹੜੇ ਅੰਮ੍ਰਿਤਸਰ 'ਚ ਸਕੂਲ ਵਧੀਆ ਨੇ

ਹਾਂਜੀ ਇਹੀ ਚੀਜ਼ ਨਾ ਤੁਹਾਨੂੰ ਪਤਾ ਏ ਵੀ ਦੇਖਣਾ ਪੈਂਦਾ ਜਦੋਂ ਆਪਾਂ ਫੈਮਲੀ ਦੇ ਵਿੱਚ ਰਹਿ ਰਹੇ ਹਾਂ ਅਤੇ ਆਪਾਂ ਇਹ ਚੀਜ਼ ਦੇਖੀਏ ਚਲੋ ਕੋਈ ਗੱਲ ਨਹੀਂ ਮੈਂ ਹੋਰ ਵੀ ਇੱਕ ਦੋ ਥਾਵਾਂ 'ਤੇ ਜਾ ਕੇ ਵਿਜਿਟ ਕਰਦੀ ਹਾਂ ਅਤੇ ਨਹੀਂ ਤਾਂ ਮੈਂ ਵੀ ਵੈਸੇ ਇੱਥੇ ਡੀ ਏ ਵੀ ਸਕੂਲ ਦਾ ਹੀ ਸੋਚਿਆ ਸੀ ਕਿ ਮੈਂ ਉੱਥੇ ਹੀ ਬੱਚਿਆਂ ਨੂੰ ਪਾ ਦੇਵਾਂ ਦੋਨਾਂ ਨੂੰ ਹਾਂ ਠੀਕ ਹੈ ਦੀਦੀ ਕੋਈ ਨਹੀਂ ਮਿਲਦੇ ਹਾਂ ਫਿਰ ਓਕੇ